ਸਤਿ ਸ਼੍ਰੀ ਅਕਾਲ ਜੀ ਜੀ ਮੈਂ ਤੁਹਾਡੀ ਫਲਿਪਕਾਰਟ ਤੋਂ ਇੱਕ ਔਰਡਰ ਬੁੱਕ ਕੀਤਾ ਸੀ ਜਿਸ 'ਚ ਮੈਂ ਫੇਸ ਕਰੀਮ ਮੰਗਵਾਈ ਸੀ ਜੋ ਬਹੁਤ ਹੀ ਵਧੀਆ ਨਿਕਲੀ ਮੇਰੇ ਡਾਰਕ ਸਰਕਲ ਬਹੁਤ ਜ਼ਿਆਦਾ ਸੀ ਅਤੇ ਉਹਦੇ ਕਾਰਨ ਉਹ ਲਗਾਉਣ ਕਾਰਨ ਲਗਾਤਾਰ ਮੈਂ ਉਹਨੂੰ ਦਸ ਦਿਨ ਅਪਲਾਈ ਕੀਤਾ ਅਤੇ ਹੁਣ ਮੇਰੇ ਡਾਰਕ ਸਰਕਲ ਜੋ ਹੈ ਬਿਲਕੁਲ ਹੀ ਖਤਮ ਹੋ ਗਏ ਹਨ ਅਤੇ ਮੈਂ ਤੁਹਾਡੀ ਸਰਵਿਸ ਤੋਂ ਬਹੁਤ ਜ਼ਿਆਦਾ ਖੁਸ਼ ਹੈਗੀ ਹਾਂ ਇਸ ਤਰਾਂ ਮੈਂ ਚਾਹੁੰਦੀ ਹਾਂ ਕਿ ਮੈਂ ਅੱਗੇ ਵੀ ਤੁਹਾਡੇ ਤੋਂ ਔਰਡਰ ਕਰਦੀ ਰਹਾਂ ਅਗਰ ਮੈਨੂੰ ਕੋਈ ਦਿੱਕਤ ਆਉਂਦੀ ਹੈ ਜਿਵੇਂ ਹੁਣ ਮੈਨੂੰ ਥੋੜ੍ਹੀ ਜਿਹੀ ਬਲੈਮਸ਼ਿਸ਼ ਦੀ ਦਿੱਕਤ ਹੈਗੀ ਹੈ ਅਤੇ ਮੈਂ ਚਾਹੁੰਦੀ ਹਾਂ ਤੁਸੀਂ ਉਹਦੇ ਵਾਸਤੇ ਵੀ ਇੱਕ ਮੈਨੂੰ ਕ੍ਰੀਮ ਭੇਜ ਦਿੱਤੀ ਜਾਵੇ ਧੰਨਵਾਦ ਬਹੁਤ ਬਹੁਤ